ਮੈਨੂੰ ਫੋਟੋਗ੍ਰਾਫੀ ਕਰਨਾ ਬਹੁਤ ਪਸੰਦ ਹੈ ਮੈਂ ਬਚਪਨ ਤੋਂ ਹੀ ਫੋਟੋਗ੍ਰਾਫੀ ਸਿੱਖਦੀ ਆਈ ਹਾਂ ਫੋਟੋਗ੍ਰਾਫੀ ਕਰਨ ਨਾਲ ਮੈਂ ਬਹੁਤ ਵਧੀਆ ਚੀਜ਼ਾਂ ਨੂੰ ਇਕੱਠਾ ਕਰਕੇ ਉਹਨਾਂ ਦੀ ਵੀਡੀਓ ਬਣਾਉਂਦੀ ਹਾਂ ਫੋਟੋਗ੍ਰਾਫੀ ਇੱਕ ਬਹੁਤ ਵਧੀਆ ਚੀਜ਼ ਹੈ ਇਸ ਨਾਲ ਤੁਸੀਂ ਆਪਣੀਆਂ ਯਾਦਾਂ ਨੂੰ ਆਪਣੇ ਕੋਲ ਸੰਭਾਲ ਕੇ ਰੱਖ ਸਕਦੇ ਹੋ ਅੱਜ ਕੱਲ੍ਹ ਦੇ ਵਿਆਹ ਦੀ ਫੋਟੋਗ੍ਰਾਫੀ ਬਹੁਤ ਸਾਰੀਆਂ ਚੀਜ਼ਾਂ ਵੱਲ ਹੋ ਗਈ ਹੈ ਵਿਆਹ ਵਿੱਚ ਜਿਵੇਂ ਬਹੁਤ ਫੰਕਸ਼ਨ ਹੁੰਦੇ ਹਨ ਸ਼ਗਨ ਹਲਦੀ ਮਹਿੰਦੀ ਵਿਆਹ ਆਦਿ ਮੈਂ ਹਰ ਇੱਕ ਚੀਜ਼ ਦੀ ਫੋਟੋਗ੍ਰਾਫੀ ਕਰਦੀ ਹਾਂ ਹਲਦੀ ਵਿੱਚ ਵੀ ਲੋਕ ਅਲੱਗ ਅਲੱਗ ਤਰ੍ਹਾਂ ਦੇ ਫਪੋਸ ਬਣਾਉਂਦੇ ਹਨ ਅਤੇ ਮੈਂ ਉਹਨਾਂ ਦੀਆਂ ਫੋਟੋਆਂ ਖਿੱਚਦੀ ਹਾਂ ਮਹਿੰਦੀ ਵਿੱਚ ਵੀ ਲੋਕ ਮਹਿੰਦੀ ਲਗਾ ਕੇ ਉਸ ਦੀ ਫੋਟੋਗ੍ਰਾਫੀ ਖਿੱਚਵਾਉਂਦੇ ਹਨ ਫੋਟੋਗ੍ਰਾਫੀ ਕਰਨਾ ਇੱਕ ਬਹੁਤ ਵਧੀਆ ਚੀਜ਼ ਹੈ ਫੋਟੋਗ੍ਰਾਫੀ ਨਾਲ ਮੈਂ ਬਹੁਤ ਸਾਰੀਆਂ ਚੀਜ਼ਾਂ ਨੂੰ ਵੇਖ ਚੁੱਕੀ ਹਾਂ ਮੈਂ ਫੋਟੋਗ੍ਰਾਫੀ ਬਹੁਤ ਵਧੀਆ ਕਰਦੀ ਹਾਂ ਅੱਜ ਕੱਲ੍ਹ ਲੋਕ ਬਹੁਤ ਤਰ੍ਹਾਂ ਦੀਆਂ ਫੋ ਫੋਟੋਗ੍ਰਾਫੀਆਂ ਕਰਦੇ ਹਨ ਨਵੇਂ ਡਿਜ਼ਾਇਨ ਬਣਾਉਂਦੇ ਹਨ ਫੋਟੋਗ੍ਰਾਫੀ ਨਾਲ ਮੈਂ ਬਹੁਤ ਸਾਰੀਆਂ ਚੀਜ਼ਾਂ ਨੂੰ